ਮੈਂ ਆਪਣੇ ਜੀਵਨ ਇਸ ਵਕਤ ਵਿੱਚ ਹੁਣ ਅਟੈਂਡੈਂਟ ਦਾ ਕੰਮ ਕਰ ਰਿਹਾ ਹਾਂ ਅਤੇ ਮੈਂ ਆਪਣੀ ਪਹਿਲਾਂ ਬੀ ਏ ਦੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਪਹਿਲਾਂ ਛੋਟੇ ਲੈਵਲ ਦਾ ਕੰਮ ਸ਼ੁਰੂ ਕੀਤਾ ਫਿਰ ਮੇਰੇ ਸਰਾਂ ਨੇ ਮੇਰੇ ਡਿਪਾਰਟਮੈਂਟ ਦੇ ਜੋ ਸਰ ਸੀ ਉਨ੍ਹਾਂ ਨੇ ਮੇਰਾ ਕੰਮ ਦੇ ਪ੍ਰਤੀ ਨਿਸ਼ਠਾ ਦੇਖਦੇ ਹੋਏ ਮੈਨੂੰ ਲੈਬ ਅਟੈਡੈਂਟ ਦੇ ਕੰਮ 'ਤੇ ਰੱਖ ਲਿੱਤਾ ਅਤੇ ਹੁਣ ਮੈਂ ਆਪਣੇ ਕੰਮ ਨੂੰ ਬੜੇ ਲਗਨ ਨਾਲ ਕਰਦਾ ਹਾਂ ਅਤੇ ਇਸ ਵਿੱਚ ਮੈਨੂੰ ਕਾਫ਼ੀ ਕੁਛ ਸਿੱਖਣ ਨੂੰ ਮਿਲਦਾ ਹੈ ਜਿ ਅਤੇ ਮੇਰੇ ਸਟਾਫ਼ ਦੇ ਮੈਂਬਰ ਵੀ ਬਹੁਤ ਸਾਰੇ ਮੇਰੀ ਹੈਲਪ ਫੁੱਲ ਮਦਦ ਕਰਦੇ ਹਨ ਅਤੇ ਮੈਨੂੰ ਬਹੁਤ ਚੰਗਾ ਮਿਹਨਤ ਹਾਰਡਵਰਕਿੰਗ ਦੇ ਲਈ ਪ੍ਰੇਰਿਤ ਕਰਦੇ ਹਨ ਅਤੇ ਮੈਨੂੰ ਵੀ ਆਪਣੇ ਕੰਮ ਵਿੱਚ ਬੜਾ ਸ ਮਜ਼ਾ ਆਉਦਾ ਹੈ ਅਤੇ ਮੈਂ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਨਾ ਚਾਹੁੰਦਾ ਹਾਂ ਅਤੇ